ਮੀਡੀਏ ਜ ਜਿਹੜੀ ਮੀਡੀਆ ਦੀ ਕੋਈ ਵੀ ਹੋਸਪਿਟਲ ਦੀ ਕੋਈ ਵੀ ਸਮੱਸਿਆ ਉਹਨੂੰ ਮੀਡੀਆ ਰਾਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਸਮੱਸਿਆ ਦੀਆਂ ਰਿਪੋਰਟ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਵੇਂ ਕਿ ਹਸਪਤਾਲ ਦੀ ਸਥਿਤੀ ਦਵਾਈਆਂ ਦੀ ਕਮੀ ਡਾਕਟਰਾਂ ਦੀ ਹੜਤਾਲ ਅਤੇ ਸਿਹਤ ਸੇਵਾ ਬਾਰੇ ਚੰਗੀ ਜਾਣਕਾਰੀ ਸਰਗਰਮੀਆਂ ਅਤੇ ਫਿਲਮਾਂ ਬਾਰੇ ਦੱਸਣਾ ਚਾਹੁੰਦਾ ਹਾਂ ਜਿਵੇਂ ਕਿ ਸਿਹਤ ਮੰਤਰਾਲੇ ਵੱਲੋਂ ਚਲਾਈਆਂ ਜਾਣ ਵਾਲੀਆਂ ਮਹਿਮਾ ਜਿਵੇਂ ਕਿ ਟੀਕਾਕਰਨ ਅਭਿਆਨ ਮਲੇਰੀਆ ਨਿਰਜੰਤਰ ਅਤੇ ਸਫਾਈ ਮੁਹਿੰਮਾਂ ਦੀਆਂ ਖਬਰਾਂ ਪਹੁੰਚਾਈਆਂ ਜਾਂਦੀਆਂ ਹਨ ਕਈ ਵਾਰ ਮੀਡੀਆ ਵੱਲੋਂ ਉਠਾਏ ਗਏ ਮੁੱਦੇ ਲੋਕਾਂ ਦੀਆਂ ਸਿਹਤ ਸੇਵਾਵਾਂ ਦਾ ਹੱਲ ਕਰਵਾਉਣ ਲਈ ਬਹੁਤ ਜ਼ਿਆਦਾ ਕਾਰਗਿਲ ਸਾਬਤ ਹੁੰਦੇ ਹਨ ਸਾਰ ਦਿ ਸਾਹ ਦਿੰਦੇ ਹਨ ਮੀਡੀਆ ਇਹ ਜਾਣਕਾਰੀ ਦਿੰਦਾ ਹੈ ਕਿ ਕਿਸੇ ਨੂੰ ਹਾਰਟ ਅਟੈਕ ਸ਼ੂਗਰ ਜਾਂ ਹੋਰ ਬਿਮਾਰੀਆਂ ਤੋ ਕਿਵੇਂ ਬਚਾਇਆ ਜਾ ਸਕਦਾ ਹੈ ਮੀਡੀਆ ਵਾਲੀ ਨਿਊਜ਼ ਚੈਨਲਾਂ ਅਤੇ ਅਭਿਆਨ ਜਾਗਰਿਤਾ ਮੁਹਿੰਮਾਂ ਅਤੇ ਮੀਡੀਆ ਰਾਹੀਂ ਲੋਕਾਂ ਦੀ ਰੋਕਥਾਮ ਦੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਮੀਡੀਆ ਜੋ ਵੀ ਹੋਸਪਿਟਲਾਂ ਦੇ ਵਿੱਚ ਮਤਲਬ ਅੱਛਾ ਹੋ ਰਿਹਾ ਉਹਨੂੰ ਵੀ ਮੀਡੀਆ ਰਾਹੀਂ ਦਰਸਾਇਆ ਜਾਂਦਾ ਹੈ ਜਿਹੜਾ ਕੋਈ ਮਤਲਬ ਕਿ ਡਾਕਟਰ ਦੀ ਕਮੀ ਜਾਂ ਦਵਾਈ ਦੀ ਕਮੀ ਜਾਂ ਕੋਈ ਡਾਕਟਰਾਂ ਦੇ ਅਣਗੈਲੀ ਉਹ ਵੀ ਮੀਡੀਆ ਵੱਲੋਂ ਦੱਸੀ ਜਾਂਦੀ ਹੈ ਮੀਡੀਆ ਵਾਲੇ ਸਫਲਤਾ ਦੀਆਂ ਕਹਾਣੀਆਂ ਅਖਬਾਰਾਂ ਦੀ ਨਿਊਜ਼ ਵੀ ਕਵਰ ਕਰਦੇ ਹਨ ਜਿਵੇਂ ਕਿ ਨਵੀਂ ਨਵੀਆਂ ਤਕਨੀਕਾਂ ਨਵੇਂ ਇਲਾਜ ਅਨੁਸਥਾਨ ਪੰਜਾਬ ਵਿੱਚ ਮੀਡੀਆ ਸਿਹਤ ਅਤੇ ਤੰਦਰੁਸਤੀ ਨਾਲ ਸੰਬੰਧਿਤ ਮੁੱਦਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਇਹਨਾਂ ਦਾ ਅਹਿਮ ਰੋਲ ਹੁੰਦਾ ਹੈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜਿਸ ਨਾਲ ਲੋਕਾਂ ਦੀ ਸਿਹਤ ਸੰਬੰਧੀ ਜਾਗਰੂਕਤਾ ਵੱਧਦੀ ਹੈ ਮੀਡੀਆ ਬਹੁਤ ਵਧੀਆ ਮਤਲਬ ਇੱਕ ਉਪਰਾਲਾ ਹੈ ਲੋਕਲ ਮੀਡੀਆ ਅੱਛੀ ਮਤਲਬ ਸਵੈ ਲੈ ਕੇ ਚੱਲਦੇ ਨੇ ਮੀਡੀਆ ਅੱਛੀ ਮਤਲਬ ਜਿਵੇਂ ਕਹਿ ਦਈਏ ਬਹੁਤ ਵਧੀਆ ਇਹਨਾਂ ਦਾ ਉਹ ਹੈ ਲਾਸਟ 'ਤੇ ਮੇਰਾ ਇਹ ਕਹੂੰਗਾ ਮੈਂ ਲਾਸਟ ਧੰਨਵਾਦ ਕਰਨਾ ਚਾਹੁੰਦਾ ਮੀਡੀਆ ਦਾ ਅਤੇ ਵਧੀਆ ਮਤਲਬ ਕਾਰਜਕਾਰੀ ਕਰ ਰਹੇ ਨੇ